ਹਵਾਲਾ ਫੋਟੋਆਂ ਦੇ ਨਾਲ ਡਰਾਇੰਗ ਬਨਾਮ ਜੀਵਨ ਤੋਂ ਡਰਾਇੰਗ ਤੱਕ ਪਹੁੰਚਣਾ ਇੱਕ ਆਸਾਨ ਕੰਮ ਨਹੀਂ ਹੈ ਕੁਛ ਇਨਸਾਨ ਤਾਂ ਇਸਨੂੰ ਬਹੁਤ ਆਰਾਮ ਨਾਲ ਕਰ ਲੈਂਦੇ ਆ ਅਤੇ ਕਈਆਂ ਲਈ ਬਹੁ ਬਹੁਤ ਚੁਣੋਤੀਪੂਰਨ ਕੰਮ ਹੈ ਕੁਛ ਬੱਚੇ ਵੀ ਇਸ ਆਪਣੀ ਸੋਚ ਦੇ ਨਾਲ ਇਸ ਨੂੰ ਬਹੁਤ ਜਲਦੀ ਕਰ ਲੈਂਦੇ ਹਨ ਕਈ ਵਾਰ ਮੈਂ ਆਪਣੇ ਫੋਟੋ ਦੇ ਰਾਹੀਂ ਆਪਣੇ ਘਰ ਬਣਾਉਣ ਦਾ ਸੁਪਨਾ ਦੇਖਿਆ ਤੇ ਅਤੇ ਉਸਨੂੰ ਸਕਾਰ ਰੂਪ ਵਿੱਚ ਡਰਾਇੰਗ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਮੈਂ ਥੋੜ੍ਹਾ ਨਕਾਮ ਰਿਹਾ ਕਿਉਂਕਿ ਜੋ ਮੇਰਾ ਜੀਵਨ ਵਿੱਚ ਮੈਂ ਸੋਚਿਆ ਹੈ ਮੇਰੇ ਦਿਮਾਗ 'ਚ ਚੱਲਦਾ ਹੈ ਕਿ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਦਾ ਇਹ ਬਣੇਗਾ ਫੋਟੋ ਵਿੱਚ ਤਾਂ ਮਿਲ ਜਾਏਗਾ ਪਰ ਉਹ ਉਸ ਨੂੰ ਮੈਂ ਡਰਾਇੰਗ ਵਿੱਚ ਤਬਦੀਲ ਨਹੀਂ ਕਰ ਸਕਦਾ ਮੇਰੇ ਬੇਟੇ ਨੇ ਇੱਕ ਦਿਨ ਕਾਰ ਡਰੈਂਗ ਦੇ ਵਿੱਚ ਬਣਾਈ ਜੋ ਕਿ ਉਸਨੇ ਮੇਰੇ ਫੋਨ ਵਿੱਚ ਫੋਟੋ ਦੇ ਰੂਪ 'ਚ ਦੇਖੀ ਸੀ ਅਤੇ ਮੈਂ ਦੇਖਿਆ ਕਿ ਉਹ ਹੁਣ ਇੱਕ ਨਵੀਂ ਤਰ੍ਹਾਂ ਦੀ ਕਾਰ ਬਣਾ ਰਿਹਾ ਹੈ ਜੋ ਆਪਣੀ ਆਪਣੇ ਲਈ ਉਹ ਅੱਗਿਓਂ ਚਾਹੁੰਦਾ ਹੈ ਇਹ ਕਲਪਨਾ ਸੋਚਦਾ ਹਾਂ ਕਿ ਉਸ ਦੇ ਜੀਵਨ ਨੂੰ ਕਿਵੇਂ ਅੱਗੇ ਲਿਜਾ ਸਕਦੀ ਹੈ ਇਹ ਬਹੁਤ ਅੱਛਾ ਤਰੀਕਾ ਹੈ ਧੰਨਵਾਦ